ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿ ਸਿਰਫ ਔਰਤ ਹੀ ਘਰ ਦਾ ਖਾਣਾ ਬਣਾ ਸਕਦੀ ਹੈ ਜਦ ਵੀ ਆਪਾਂ ਕਿਤੇ ਬਾਹਰ ਕਿਤੇ ਖਾਣੇ ਵਾਸਤੇ ਜਾਂਦੇ ਹਾਂ ਤਾਂ ਉੱਥੇ ਜ਼ਿਆਦਾਤਰ ਸ਼ੈਫ ਮਰਦ ਹੀ ਹੁੰਦੇ ਹਨ ਅਤੇ ਇਸ ਕਰਕੇ ਜਦੋਂ ਵੀ ਆਪਣੇ ਘਰ ਕੋਈ ਪ੍ਰੋਗਰਾਮ ਹੁੰਦਾ ਹੈ ਜਾਂ ਵਿਆਹ ਸ਼ਾਦੀਆਂ ਹੁੰਦੀਆਂ ਜ਼ਿਆਦਾਤਰ ਉੱਥੇ ਹਲਵਾਈ ਹੀ ਕੰਮ ਕਰਦੇ ਹਨ ਜੋ ਮਰਦ ਹੁੰਦੇ ਹਨ ਇਸ ਲਈ ਅੱਜ ਕੱਲ੍ਹ ਤਾਂ ਇਹ ਕਿਤੇ ਵੀ ਨਹੀਂ ਹੈਗਾ ਕਿ ਆਪਾਂ ਸਿਰਫ ਔਰਤਾਂ ਹੀ ਘਰ ਦਾ ਕੰਮ ਕਰ ਸਕਦੀਆਂ ਜਦ ਔਰਤ ਕਿਤੇ ਬਾਹਰ ਜਾ ਕੇ ਕਮਾਈ ਕਰ ਸਕਦੀ ਹੈ ਕੰਮ ਕਰ ਸਕਦੀ ਹੈ ਮਰਦ ਦੇ ਬਰਾਬਰ ਹੋ ਕੇ ਤਾਂ ਮਰਦ ਕਿਉਂ ਨਹੀਂ ਔਰਤ ਦਾ ਸਾਥ ਦੇ ਸਕਦਾ ਘਰ ਦੇ ਕੰਮ ਕਰਨ ਵਾਸਤੇ ਇਸ ਲਈ ਮੈਂ ਇਹ ਗੱਲ 'ਤੇ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿ ਸਿਰਫ ਔਰਤ ਹੀ ਘਰ ਦਾ ਕੰਮ ਸੰਭਾਲ ਸਕਦੀ ਹੈ ਜਦਕਿ ਜਦ ਵੀ ਕੋਈ ਵੀ ਮਤਲਬ ਮੇਰੇ ਘਰ ਦੇ ਵਿੱਚ ਮੈਂ ਜਦ ਵੀ ਕਿਤੇ ਕੋਈ ਬਿਮਾਰ ਹੁੰਦੀ ਹਾਂ ਜਾਂ ਮੈਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਮੇਰੇ ਹਸ ਮੇਰੇ ਮਤਲਬ ਜੋ ਹਸਬੈਂਡ ਨੇ ਉਹ ਮੈਨੂੰ ਹਰ ਇੱਕ ਚੀਜ਼ ਬਣਾ ਕੇ ਦਿੰਦੇ ਨੇ ਜਿਵੇਂ ਕੋਈ ਮੈਨੂੰ ਚਾਹ ਬਣਾ ਕੇ ਦੇ ਤੀ ਜਾਂ ਜਦ ਮੈਂ ਜ਼ਿਆਦਾ ਥੱਕੀ ਹੁੰਦੀ ਹਾਂ ਤਾਂ ਉਹ ਮੇਰੇ ਲਈ ਖਾਣਾ ਵੀ ਤਿਆਰ ਕਰਦੇ ਨੇ ਅਤੇ ਇਸ ਲਈ ਮੈਂ ਇਹ ਮਤਲਬ ਇਸ ਗੱਲ ਦੇ ਬਿਲਕੁਲ ਵੀ ਸਹਿਮਤ ਨਹੀਂ ਹਾਂ ਕਿ ਔਰਤ ਅਤੇ ਮਰਦ ਮਤਲਬ ਵਿੱਚ ਕੋਈ ਫਰਕ ਹੁੰਦਾ ਹੈ ਅੱਜ ਕੱਲ੍ਹ ਤਾਂ ਸਰਕਾਰ ਨੇ ਇਹ ਕਾਨੂੰਨ ਬਣਾਇਆ ਹੈ ਕਿ ਔਰਤ ਅਤੇ ਮਰਦ ਦੇ ਵਿੱਚ ਕੋਈ ਫਰਕ ਨਹੀਂ ਹੈ ਉਹ ਦੋਨੋਂ ਬਰਾਬਰ ਨੇ ਇਸ ਲਈ ਤੁਸੀਂ ਇਸ ਗੱਲ ਦੇ ਬਿਲਕੁਲ ਵੀ ਸਹਿਮਤ ਨਾ ਹੋਵੋ ਕਿ ਔਰਤ ਹੀ ਘਰ ਸੰਭਾਲ ਸਕਦੀ ਹੈ ਜਦਕਿ ਇਹ ਦੋਨੋਂ ਬਾਹਰ ਜਾ ਕੇ ਕਮਾਈ ਕਰ ਸਕਦੇ ਨੇ ਤਾਂ ਦੋਨੋਂ ਆਪਣੇ ਆਪ ਦਾ ਘਰ ਵੀ ਸੰਭਾਲ ਸਕਦੇ ਨੇ ਆਪਣੇ ਆਪ ਦੀ ਰਸੋਈ ਵੀ ਸੰਭਾਲ ਸਕਦੇ ਹਨ ਅਤੇ ਜਦੋਂ ਵੀ ਕੋਈ ਵੀ ਕਿਸੇ ਨੂੰ ਵੀ ਦੋਨਾਂ 'ਚੋਂ ਜ਼ਰੂਰਤ ਪੈਂਦੀ ਹੈ ਤਾਂ ਜਾਂ ਜੇ ਔਰਤ ਨੂੰ ਬਾਹਰ ਕੰਮ ਹੈ ਤਾਂ ਮਰਦ ਆਪਣੇ ਘਰ ਬੈਠ ਕੇ ਘਰ ਦਾ ਕੰਮ ਸ ਹੀ ਵੀ ਸੰਭਾਲ ਸਕਦਾ ਹੈ ਅਤੇ ਜੇ ਔਰਤ ਅਤੇ ਮਰਦ ਇੱਕ ਬਰਾਬਰ ਹੋ ਕੇ ਘਰ ਦਾ ਕੰਮ ਸੰਭਾਲਣਗੇ ਤਾਂ ਉਨ੍ਹਾਂ ਨੂੰ ਬਹੁਤ ਹੀ ਵਧੀਆ ਲੱਗੇਗਾ ਅਤੇ ਉਹ ਇੱਕ ਬਰਾਬਰ ਹਨ ਤਾਂ ਉਹ ਕੰਮ ਵੀ ਇੱਕ ਬਰਾਬਰ ਹੀ ਕਰਨ